ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਸਨੀ ਟਰੈਵਲਸ ਤੋਂ ਬੋਲਦੇ ਹੋ ਹਾਂਜੀ ਅਸੀਂ ਅੱਜ ਕੈਬ ਬੁੱਕ ਕਰਨੀ ਸੀ ਜੀ ਅਰਬਨ ਸਟੇਟ ਫੇਸ ਟੂ ਤੋਂ ਬੋਲਦਾ ਜੀ ਮੈਂ ਅਸੀਂ ਛੇ ਮੈਂਬਰ ਹੈ ਜੀ ਹਾਂਜੀ ਅਸੀਂ ਚੰਡੀਗੜ੍ਹ ਜੂ ਘੁੰਮਣ ਜਾਣਾ ਜੀ ਕਿੰਨੇ ਚਾਰਜ ਹੋਣਗੇ ਤੁਹਾਡੀ ਕੈਬ ਦੇ ਜੀ ਠੀਕ ਹੈ ਜੀ ਤੁਹਾਡੀ ਕੈਬ ਸਾਡੇ ਕੋਲ ਕਿੰਨੇ ਸਮੇਂ ਤੱਕ ਪਹੁੰਚ ਜਾਵੇਗੀ ਹਾਂਜੀ ਅਸੀਂ ਹਰ ਵਾਰੀ ਘੁੰਮਣ ਵੇਲੇ ਤੁਹਾਡੀ ਹੀ ਕੈਬ ਦਾ ਇਸਤੇਮਾਲ ਕਰਦੇ ਹਾਂ ਜੀ ਸਾਨੂੰ ਬਹੁਤ ਆਨੰਦ ਆਉਂਦਾ ਜੀ ਤੁਹਾਡੀ ਕੈਬ 'ਚ ਘੁੰਮਣ 'ਚ ਠੀਕ ਹੈ ਜੀ